ਮੇਰਾ ਨਾ ਕੁਝ ਦਿਨਾਂ ਤੋਂ ਇੰਟਰਨੈਟ ਕਨੈਕਸ਼ਨ ਜਿਹੜਾ ਹੈ ਉਹ ਉਹਦੀ ਸਪੀਡ ਘੱਟ ਗਈ ਹੈ ਤੇ ਮੈਂ ਚਾਹੁੰਦਾ ਸੀ ਕਿ ਤੁਸੀਂ ਮੈਨੂੰ ਦੱਸੋ ਕਿ ਮੇਰਾ ਇੰਟਰਨੈਟ ਪੈਕੇਜ ਕ ਖਤਮ ਹੋ ਗਿਆ ਕਿ ਵੀ ਮੇਰਾ ਉੱਦਾਂ ਹੀ ਕੁਛ ਟੈਕਨੀਕਲ ਫੋਲਟ ਹੈਗਾ ਜੇ ਪੈਸੇ ਚਾਹੀਦੇ ਹੈਗੇ ਤਾਂ ਦੱਸ ਦਓ ਕਿ ਮੈਂ ਰੀਚਾਰਜ ਕਰਵਾਉਣਾ ਤਾਂ ਕਿੱਦਾਂ ਕਰਵਾਉਣਾ ਮੈਨੂੰ ਇਹਦੀ ਪ੍ਰੋਪਰ ਇਨਫੋਰਮੇਸ਼ਨ ਵੀ ਨਹੀਂ ਮਿਲ ਰਹੀ ਤੁਹਾਡੀ ਐਪ ਨਹੀਂ ਚਲਦੀ ਪਈ ਹੈ ਅਤੇ ਤਾਂ ਉੱਥੇ ਦੇਖ ਲੈਂਦੇ ਸੀਗੇ ਤਾਂ ਆਪਾਂ ਉੱਥੋਂ ਡਾਰੈਕਟਲੀ ਉੱਥੋਂ ਰੀਚਾਰਜ ਕਰ ਕਰਦੇ ਤਾਂ ਕਰਕੇ ਮੈਨੂੰ ਆਪਰੇਟਰ ਨੂੰ ਕਾਲ ਕਰਨਾ ਪੈ ਰਿਹਾ ਅਤੇ ਦੱਸੋ ਕਿ ਥੋੜ੍ਹੀ ਚਿੰਤਾ ਪ੍ਰਗਟ ਹੈਗੀ ਹੈ ਕਿ ਮੈਂ ਹੁਣ ਆਪਣਾ ਕੰਮ ਕਰਨਾ ਸੀ ਤਾਂ ਕੰਮ ਕਿੱਦਾਂ ਕਰਾਂ ਜੇ ਕਨੈਕਸ਼ਨ ਵਧੀਆ ਨਹੀਂ ਹੈ ਸਪੀਡ ਬਹੁਤ ਘੱਟ ਹੈ ਸਪੀਡ ਇੰਨੀ ਹੈ ਨਹੀਂ ਕਿ ਜੇ ਇੱਕ ਵੈਬਸਾਈਟ ਵੀ ਨਹੀਂ ਖੁੱਲ੍ਹਦੀ ਤਾਂ ਕਰਕੇ ਕਹਿ ਰਹੇ ਸੀਗੇ